ਸਾਡੇ ਪਿੰਡ ਵਿੱਚ ਇੱਕ ਪਾਰਕ ਬਣੀ ਹੋਈ ਹੈ ਜਿੱਥੇ ਰੋਜ਼ਾਨਾ ਸ਼ਾਮ ਨੂੰ ਬੱਚੇ ਜਾਂਦੇ ਹਨ ਅਤੇ ਆਪਣਾ ਖੇਡ ਕੁੱਦ ਕੇ ਘਰੇ ਆਉਂਦੇ ਹਨ ਅਤੇ ਇੱਕ ਵਾਲੀਬਾਲ ਦਾ ਨੈੱਟ ਵੀ ਲੱਗਿਆ ਹੋਇਆ ਹੈ ਜਿੱਥੇ ਬੱਚੇ ਵਾਲੀਬਾਲ ਖੇਡਦੇ ਹਨ ਤਾਂ ਉਹਨਾਂ ਦੀ ਸਿਹਤ ਤੰਦਰੁਸਤ ਰਹਿੰਦੀ ਹੈ